ਮੈਂ ਰੂਪਨਗਰ ਜ਼ਿਲ੍ਹੇ ਦਾ ਹੀ ਰਹਿਣ ਵਾਲਾ ਹਾਂ ਮੇਰੇ ਜ਼ਿਲ੍ਹੇ ਦੇ ਅੰਦਰ ਕਈ ਪ੍ਰਕਾਰ ਦੇ ਭਾਸ਼ਾਈ ਸਮੂਹ ਰਹਿੰਦੇ ਹਨ ਜਿਵੇਂ ਯੂ ਪੀ ਤੋਂ ਬਿਹਾਰ ਤੋਂ ਰਾਜਸਥਾਨ ਤੋਂ ਆ ਕੇ ਅਲੱਗ ਅਲੱਗ ਜਾਤ ਦੇ ਅਲੱਗ ਅਲੱਗ ਭਾਸ਼ਾ ਦੇ ਬੋਲਣ ਵਾਲੇ ਆਦਮੀ ਵਸੀਲੇ ਹੈਗੇ ਨੇ ਉਨ੍ਹਾਂ ਦੀਆਂ ਜਾਤਾਂ ਵੀ ਅਲੱਗ ਅਲੱਗ ਹਨ ਅਤੇ ਕਬੀਲੇ ਵੀ ਅਲੱਗ ਅਲੱਗ ਹਨ ਭਾਸ਼ਾਵਾਂ ਵੀ ਅਲੱਗ ਅਲੱਗ ਹਨ ਅਤੇ ਸੱਭਿਆਚਾਰ ਵੀ ਅਲੱਗ ਅਲੱਗ ਹਨ ਉਹ ਆਪਣੇ ਆਪਣੇ ਕਬੀਲੇ ਦੇ ਸਮੂਹਾਂ ਬਾਰੇ ਵੀ ਜਾਣਦੇ ਹਨ ਅਤੇ ਉਸ ਸਮੂਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਆਪਣੇ ਆਪਣੇ ਤਿੱਥ ਤਿਉਹਾਰ ਵੀ ਉਸ ਤਰੀਕੇ ਨਾਲ ਮਨਾਉਂਦੇ ਹਨ ਜੋ ਅਲੱਗ ਅਲੱਗ ਖੇਤਰ ਦੇ ਆਦਮੀ ਹਨ ਉਹ ਆਪਣੇ ਵੀ ਤਿਉਹਾਰ ਮਨਾਉਂਦੇ ਹਨ ਅਤੇੇ ਇੱਧਰਲੇ ਪੰਜਾਬੀਆਂ ਦੇ ਵੀ ਤਿਉਹਾਰ ਮਨਾਉਂਦੇ ਹਨ ਅਸੀਂ ਵੀ ਉਹਨਾਂ ਨਾਲ ਹਿੰਦੀ ਵਿੱਚ ਗੱਲ ਕਰਦੇ ਹਨ ਅਤੇ ਉਹ ਵੀ ਹਿੰਦੀ ਵਿੱਚ ਗੱਲ ਕਰਦੇ ਹਨ ਅਤੇ ਜੋ ਅੱਗੇ ਸਾਡੀ ਬੱਚਿਆਂ ਦੀ ਰੂਪ ਰੇਖਾ ਹੈ ਉਹ ਅੱਜ ਕੱਲ੍ਹ ਜ਼ਿਆਦਾ ਹਿੰਦੀ ਨੂੰ ਅਤੇ ਇੰਗਲਿਸ਼ ਨੂੰ ਜ਼ਿਆਦਾ ਬੋਲਦੇ ਹਨ ਲੇਕਿਨ ਅਸੀਂ ਪੰਜਾਬ ਦੇ ਰਹਿਣ ਵਾਲੇ ਹਨ ਉਹਨਾਂ ਨੂੰ ਸਾਡੇ ਬੱਚਿਆਂ ਨੂੰ ਜ਼ਿਆਦਾ ਪੰਜਾਬੀ ਭਾਸ਼ਾ ਹੀ ਬੋਲਣੀ ਚਾਹੀਦੀ ਹੈ